ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਤਾਂ ਨਹੀਂ ਕਿਸੇ ਪ੍ਰਦਰਸ਼ਨੀ ਜਾਂ ਐਕਸਪੋਜ ਦਾ ਦੌਰ ਕੀਤਾ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਵਾਰ ਕਿਸੇ ਵੱਡੇ ਤੋਂ ਵੱਡੇ ਐਕਸਪੋਜ 'ਤੇ ਜਾਣਾ ਜ਼ਰੂਰ ਚਾਹੂੰਗੀ ਕਿਉਂਕਿ ਉੱਥੇ ਜਾ ਕੇ ਇੰਨੇ ਸਾਰੇ ਲੋਕਾਂ ਦੇ ਵਿੱਚ ਕੁਝ ਨਵਾਂ ਅਤੇ ਬਹੁਤ ਵਧੀਆ ਸਿੱਖਣ ਨੂੰ ਮਿਲੇਗਾ ਉਸ ਐਕਸਪੋਜ 'ਤੇ ਬਹੁਤ ਸਾਰੀਆਂ ਕਿਉਂਕਿ ਹਰ ਇੱਕ ਐਕਸਪੋਜ 'ਤੇ ਬਹੁਤ ਸਾਰੀਆਂ ਵਧੀਆ ਵਧੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਅਤੇ ਉਥੋਂ ਜਿਹੜੇ ਲੋਕ ਭਾਸ਼ਣ ਦਿੰਦੇ ਹਨ ਇੰਨਾਂ ਕੁ ਵਧੀਆ ਹੁੰਦਾ ਕਿ ਬੰਦੇ ਦੇ ਮਨ ਵਿੱਚ ਆਪੇ ਹੀ ਉਤਸਾਹ ਪੈਦਾ ਕਰ ਦਿੰਦਾ ਅਤੇ ਸਾਡੇ ਕੰਮ ਕਰਨ ਦੇ ਹੌਂਸਲੇ ਨੂੰ ਹੋਰ ਵਧਾਉਂਦਾ ਅਤੇ ਇਸ ਕਰਕੇ ਮੈਂ ਜ਼ਰੂਰ ਚਾਹੂੰਗੀ ਕਿ ਮੈਂ ਕਿਸੇ ਨਾ ਕਿਸੇ ਐਕਸਪੋਜ 'ਤੇ ਜਾਵਾਂ ਤਾਂ ਕਿ ਮੇਰੀ ਜਿਹੜੀ ਕਲਾ ਵਾ ਉਸ ਉਹ ਉਸਨੂੰ ਹੋਰ ਸਫਲਤਾ ਮਿਲ ਸਕੇ ਅਤੇ ਮੈਂ ਹੋਰ ਜਾਗਰੂਕਤਾ ਅਤੇ ਉਤਸ਼ਾਹ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਾਂ